ਪੇਂਡੂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਖੋ ਖੋ ਖੇਡੀ ਜਾਂਦੀ ਹੈ ਜਿਵੇਂ ਕਿ ਪੀੜਾ ਖੇਡਿਆ ਜਾਂਦਾ ਹੈ ਕੁੜੀਆਂ ਦੀ ਖੇਡ ਹੈ ਕੋਟਲਾ ਛਪਾਕੀ ਜੁੰਮੇ ਰਾਤ 'ਤੇ ਜਿਹੜਾ ਅੱਗੜ ਪਿੱਛੜ ਘੁੰਮ ਕੇ ਵੇਖੂ ਉਹਦੀ ਸ਼ਾਮਤ ਆਈ ਹੈ ਜਿਵੇਂ ਕਿ ਖੋ ਖੋ ਖੇਡੀ ਜਾਂਦੀ ਹੈ ਜਿਵੇਂ ਕਿ ਭੰਡਾ ਭੰਡੋਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ ਗੁੱਲੀ ਡੰਡਾ ਵੀ ਖੇਡਿਆ ਜਾਂਦਾ ਹੈ ਜਿਵੇਂ ਕਿ ਪਿੱਠੂ ਗਰਮ ਵੀ ਖੇਡਿਆ ਜਾਂਦਾ ਹੈ ਬਹੁਤ ਸਾਰੇ ਬੱਚੇ ਇਸ ਨੂੰ ਠੀਕਰਾਂ ਬਣਾ ਕੇ ਬੋਲ ਮਾਰਦੇ ਨੇ ਫਿਰ ਇੱਕ ਜਾਣਾ ਆਣ ਕੇ ਠੀਕਰਾਂ ਨੂੰ ਇਕੱਠੀਆਂ ਕਰਦਾ ਏ ਜਿਹੜਾ ਠੀਕਰੀਆਂ ਇਕੱਠੀਆਂ ਕਰਦਾ ਹੈ ਉਹਦੇ ਬੋਲ ਮਾਰੀ ਜਾਂਦੀ ਹੈ ਫਿਰ ਦੂਸਰੇ ਦੀ ਵਾਰੀ ਆ ਜਾਂਦੀ ਹੈ ਪੇਂਡੂ ਖੇਡਾਂ ਬਹੁਤ ਹੀ ਪਿਆਰੀਆਂ ਹੁੰਦੀਆਂ ਹਨ ਅਤੇ ਬਹੁਤ ਹੀ ਆਨੰਦ ਆਉਂਦਾ ਹੈ ਖੇਡਣ ਦਾ ਵਧੀਆ ਲੱਗਦੀਆਂ ਹਨ ਬੱਚੇ ਇਸਨੂੰ ਬਹੁਤ ਹੀ ਪਸੰਦ ਕਰਦੇ ਨੇ ਬਹੁਤ ਹੀ ਵਧੀਆ ਹੁੰਦੀਆਂ ਹਨ